ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਔਰਬਿਟ ਤੋਂ ਹੀ ਬੋਲਦੇ ਹਾਂ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਜਾਂਦੀਆਂ ਜੀ ਆਪਣੀਆਂ ਬੱਸਾਂ ਔਰਬਿਟ ਆਪਣੀਆਂ ਏ ਸੀ ਬੱਸਾਂ ਵੀ ਜਾਂਦੀਆਂ ਅਤੇ ਵੋਲਵੋ ਵੀ ਜਾਂਦੀਆਂ ਤੁਸੀਂ ਕਿਸ 'ਤੇ ਜਾਣਾ ਚਾਹੋਗੇ ਸਰ ਏ ਸੀ ਦਾ ਆਪਣਾ ਹੈਗਾ ਸਾਢੇ ਤਿੰਨ ਸੌ ਰੁਪਇਆ ਇੱਕ ਸਵਾਰੀ ਦਾ ਤੁਸੀਂ ਕਿੰਨੀਆਂ ਸਵਾਰੀ ਹੋ ਠੀਕ ਹੈ ਜੀ ਸਾਢੇ ਤਿੰਨ ਸੌ ਇੱਕ ਹਾਂਜੀ ਸਾਢੇ ਤਿੰਨ ਸੌ ਰੁਪਇਆ ਪਰ ਸਵਾਰੀ ਦਾ ਕਿਰਾਇਆ ਜੀ ਏ ਸੀ ਬੱਸ ਦਾ ਅਤੇ ਹਾਂਜੀ ਹਾਂਜੀ ਹਾਂਜੀ ਵਾਪਸੀ 'ਤੇ ਵੀ ਹੈ ਜਾਣਦੇ ਵੀ ਹੈ ਜਾਣ ਦੇ ਵੀ ਹੈ ਦੋਨਾਂ ਪਾਸੇ ਦਾ ਹੀ ਹੈ ਜੀ ਸਾਡੇ ਦੋਵੇਂ ਪਾਸੇ ਤੋਂ ਆਉਂਦੀ ਹੈ ਬਸ ਇੱਕ ਪਾਸੇ ਦਾ ਸਰ ਸਾਢੇ ਤਿੰਨ ਸੌ ਰੁਪਏ ਕਿਰਾਇਆ ਜੀ ਇੱਕ ਸਵਾਰੀ ਦਾ ਹਾਂਜੀ

ਦੂਸਰੀ ਵੋ ਵੋਲਵੋ ਬਸ ਹੈ ਸਰ ਸਾਡੀ ਉਹਨਾਂ ਕਿਰਾਇਆ ਸਾਢੇ ਸੱਤ ਸੌ ਰੁਪਇਆ ਇੱਕ ਸਵਾਰੀ ਦਾ ਜੀ ਹਾਂਜੀ ਉਹ ਸੁਪਰ ਫਾਸਟ ਬੱਸਾਂ ਹੁੰਦੀਆਂ ਸਰ ਉਹ ਤੁਹਾਨੂੰ ਬੜੇ ਰਿਲੈਕਸ ਸਫ਼ਰ ਕਰਵਾਉਂਣਗੀਆਂ ਉਹਦੇ ਨਾਲ ਤੁਹਾਨੂੰ ਪਤਾ ਨਹੀਂ ਲੱਗੇਗਾ ਤੁਸੀਂ ਕਦੋਂ ਅੰਮ੍ਰਿਤਸਰ ਘਰ ਪਹੁੰਚਗੇ ਨਹੀਂ ਨਹੀਂ ਸਰ ਉਹ ਬਹੁਤ ਸਾਡੀਆਂ ਇਹ ਸਿੱਧੀਆਂ ਨਾਨ ਸਟੋਪ ਬੱਸਾਂ ਆਉਂਦੀਆਂ ਬਸ ਮੇਨ ਮੇਨ ਅੱਡੇ 'ਤੇ ਰੁਕਦੀਆਂ ਕੋਈ ਜ਼ਿਆਦਾ ਲੋਕਲ ਅੱਡਿਆਂ 'ਚ ਨਹੀਂ ਰੁਕਦੀਆਂ ਹਾਂਜੀ ਹਾਂਜੀ ਜਦੋਂ ਬੁਕਿੰਗ ਸਰ ਤੁਹਾਨੂੰ ਕਾਊਂਟਰ 'ਤੇ ਆ ਕੇ ਕਰਵਾਉਣੀ ਪਏਗੀ ਸਾਡੇ ਕਾਊਂਟਰ 'ਤੇ ਸਾਡੇ ਬੈਠੇ ਹੁੰਦੇ ਆ ਕਨੈਕਟਰ ਵਗੈਰਾ ਬੈਠੇ ਹੁੰਦੇ ਆ ਉਹਨਾਂ ਕੋਲ ਆਓਗੇ ਜਦੋਂ ਤੁਸੀਂ ਉਹਨੂੰ ਦੱਸੋਗੇ ਤੇ ਉਹ ਤੁਹਾਡੀ ਉਸ ਟਾਈਮ ਬੁਕਿੰਗ ਕਰ ਦੇਣਗੇ ਸੀਟ ਦੀ ਅਵੇਲੇਬਿਲਟੀ ਦੇਖ ਕੇ ਹਾਂਜੀ ਤੁਸੀਂ ਉੱਥੇ ਜਾ ਆਇਓ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਕੋਈ ਗੱਲ ਨਹੀਂ ਓਕੇ ਜੀ ਓਕੇ ਜੀ ਓਕੇ